ਸਤਿ ਸ਼੍ਰੀ ਅਕਾਲ ਸਾਰੇ ਜਣਿਆਂ ਨੂੰ ਮੈਂ ਤੁਹਾਡੇ ਸਾਰੇ ਜਣਿਆਂ ਨੂੰ ਦੱਸਣਾ ਚਾਹਾਂਗਾ ਵੀ ਕੋਵਿਡ ਲੋਕਡਾਊਨ ਜਦੋਂ ਲੱਗਿਆ ਵਾ ਇਸ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਜਿਹੜੇ ਆ ਹਰ ਇੱਕ ਘਰ ਵਿੱਚ ਦੋ ਦੋ ਤਿੰਨ ਤਿੰਨ ਫੋਨ ਤਾਂ ਹਰ ਇੱਕ ਪਰਿਵਾਰ ਦੇ ਕੋਲ ਜਿਹੜੇ ਆ ਉਹ ਹੈ ਹੀ ਆ ਇਸ ਦੇ ਕਈ ਤਰ੍ਹਾਂ ਦੇ ਫਾਇਦੇ ਵੀ ਆ ਅਤੇ ਕਈ ਨੁਕਸਾਨ ਵੀ ਆ ਪਹਿਲਾਂ ਮੈਂ ਦੱਸਣਾ ਚਾਹਾਂਗਾ ਵੀ ਮੋਬਾਈਲ ਫੋਨ ਨੇ ਬੱਚਿਆਂ ਨੇ ਜਿਹੜੀ ਆ ਪੜ੍ਹਾਈ ਦੇ ਵਿੱਚ ਜਿਹੜੀ ਆ ਇੱਕ ਬਹੁਤ ਹੀ ਵੱਡਾ ਜਿਹੜਾ ਵਾ ਉਹ ਯੋਗਦਾਨ ਪਾਇਆ ਹੈ ਮੋਬਾਈਲ ਫੋਨ ਇੱਕ ਬਹੁਤ ਹੀ ਸਾਇੰਸਟਿਸਟਾਂ ਦੀ ਇੱਕ ਬਹੁਤ ਹੀ ਵੱਡੀ ਦੇਣ ਹੈ ਜੇ ਮੋਬਾਇਲ ਫੋਨ ਨਾ ਹੁੰਦਾ ਤਾਂ ਮੇਰੇ ਹਿਸਾਬ ਨਾਲ ਤਾਂ ਬੱਚਿਆਂ ਨੂੰ ਵਾਇਲ ਮਬਾਇਲ ਫੋਨ ਤੋਂ ਤੋਂ ਪੜ੍ਹਨ ਦੇ ਪੜ੍ਹਨ ਦਾ ਵਾ ਇੱਕ ਬਹੁਤ ਹੀ ਵਧੀਆ ਜ਼ਰੀਆ ਜਿਹੜਾ ਵਾ ਉਹ ਪੜ੍ਹਾਈ ਦੇ ਲਈ ਬਹੁਤ ਹੀ ਪੋਜੀਟਿਵ ਪੁਆਇੰਟ ਆ ਵੇਖਿਆ ਜਾਏ ਮੋਬਾਈਲ ਫੋਨ ਤੋਂ ਬੱਚਿਆਂ ਨੂੰ ਪੜ੍ਹਨਾ ਜਦੋਂ ਕਿ ਉਹਨਾਂ ਦੇ ਕੋਲ ਜਿਹੜੇ ਆ ਉਹਨਾਂ ਦੇ ਪੜ੍ਹਾਉਣ ਵਾਲੇ ਜਿਹੜੇ ਸ਼ਿਖਸ਼ਕ ਜਿਹੜੇ ਆ ਟੀਚਰ ਜਿਹੜੇ ਆ ਉਹ ਵੀ ਨਹੀਂ ਹੈਗੇ ਪਰ ਇੰਟਰਨੈਟ ਦੀ ਜਿਹੜੀ ਸੁਵਿਧਾ ਜਿਹੜੀ ਮੋਬਾਈਲਾਂ ਫੋਨਾਂ ਦੇ ਵਿੱਚ ਜਿਹੜੀ ਆਮ ਦੇਖਣ ਨੂੰ ਮਿਲਦੀ ਹੈ ਸਾਨੂੰ ਇਹਦਾ ਇੱਕ ਬਹੁਤ ਹੀ ਵੱਡਾ ਫਾਇਦਾ ਹੋਇਆ ਕਿ ਬੱਚੇ ਕਿਸੇ ਵੀ ਜਗ੍ਹਾ 'ਤੇ ਬੈਠੇ ਕਿਸੇ ਵੀ ਟਾਈਮ ਕਿਸੇ ਵੀ ਵਕਤ ਜਦੋਂ ਉਹ ਫਰੀ ਹੁੰਦੇ ਹਨ ਉਸ ਟਾਈਮ 'ਤੇ ਉਹ ਜਿਹੜਾ ਵਾ ਉਹ ਉਹਨੂੰ ਜਿਹੜਾ ਵਾ ਉਹ ਫੋਨ ਨੂੰ ਵਰਤ ਕੇ ਆਪਣੀ ਜਿਹੜੀ ਆ ਉਹ ਪੜ੍ਹਾਈ ਦੇ ਵਿੱਚ ਗਿਆਨ ਦੇ ਵਿੱਚ ਜਿਹੜਾ ਵਾ ਉਹ ਵਾਧਾ ਕਰ ਸਕਦੇ ਆ ਪਰ ਦੂਜੇ ਹੀ ਬੰਨੇ ਵੇਖਿਆ ਜਾਵੇ ਤਾਂ ਮੋਬਾਈਲ ਫੋਨ ਦਾ ਜਿਹੜਾ ਵਾ ਉਹ ਬੱਚਿਆਂ ਨੂੰ ਇੱਕ ਨੈਗਟਿਵ ਪੁਆਇੰਟ ਵੀ ਜਿਹੜਾ ਵਾ ਉਹ ਹੈਗਾ ਵਾ ਅਤੇ ਇਹਦੇ ਨੁਕਸਾਨ ਦੇ ਵਿੱਚ ਜੇ ਮੈਂ ਗੱਲ ਕਰਾਂ ਵੀ ਬੱਚੇ ਜਿਹੜੇ ਆ ਉਹ ਕਿਸੇ ਵਕਤ ਜਿਹੜੇ ਆ ਉਹ ਲੋਕਡਾਊਨ ਦੇ ਵਿੱਚ ਜਿਹੜੇ ਆ ਮਾਂ ਪਿਓ ਨੂੰ ਵੀ ਕਿਸੇ ਵੇਲੇ ਉਹ ਧੋਖਾ ਦਿੰਦੇ ਨੇ ਵੀ ਆਪਾਂ ਪੜ੍ਹ ਰਹੇ ਹਾਂ ਆਪਾਂ ਪੜ੍ਹਦੇ ਪਏ ਹਾਂ ਜਦੋਂ ਕਿਤੇ ਮਾਂ ਪਿਓ ਨੇ ਪੁੱਛਣਾ ਵੀ ਤੁਸੀਂ ਬੇਟਾ ਕੀ ਕੁਝ ਕਰ ਰਹੇ ਹੋ ਇੰਨਾ ਫੋਨ ਕਿਉਂ ਜੂਸ ਕਰ ਰਹੇ ਹੋ ਤਾਂ ਬੱਚਿਆਂ ਦੇ ਕੋਲੋਂ ਇੱਕ ਬਹੁਤ ਹੀ ਵਧੀਆ ਜਿਹੜਾ ਵਾ ਉਹ ਬਹਾਨਾ ਆ ਗਿਆ ਸੀਗਾ ਵੀ ਆਪਾਂ ਤਾਂ ਪੜ੍ਹਦੇ ਪਏ ਹਾਂ ਜੀ ਇਸ ਤਰ੍ਹਾਂ ਮੈਂ ਕਹਿਣਾ ਚਾਹਾਂਗਾ ਵੀ ਇਹ ਅਸਲ ਵਿੱਚ ਬੱਚੇ ਜਿਹੜੇ ਬੱਚੇ ਇਸ ਤਰ੍ਹਾਂ ਕਰਦੇ ਹਨ ਉਹ ਅਸਲ 'ਚ ਆਪਣੇ ਆਪ ਦੇ ਨਾਲ ਜਿਹੜਾ ਵਾ ਉਹ ਧੋਖਾ ਕਰ ਰਹੇ ਹਨ ਮਾਂ ਪਿਓ ਨੇ ਤਾਂ ਬੱਚਿਆਂ ਦੇ ਲਈ ਜਿਹੜਾ ਵਾ ਉਹ ਹਰ ਇੱਕ ਜਿਹੜਾ ਵਾ ਉਹ ਉਹਨਾਂ ਦੇ ਲਈ ਸਫਲ ਕੰਮ ਕੀਤਾ ਵਾ ਜਿਹੜਾ ਕਿ ਉਹਨਾਂ ਦੇ ਜ਼ਿੰਦਗੀ ਦੇ ਵਿੱਚ ਜਿਹੜਾ ਉਹਨਾਂ ਨੂੰ ਅੱਗੇ ਲੈ ਕੇ ਜਾਏ